ਕਲਾ ਇੱਕ ਅਜਿਹੀ ਚੀਜ਼ ਹੈ ਜਿਸ ਨਾਲ ਵਿਅਕਤੀ ਆਪ ਦੇਖ ਕੇ ਕਰਕੇ ਆਪਣੇ ਹੱਥਾਂ ਨਾਲ ਹੱਥੀਂ ਕੰਮ ਕਰਕੇ ਬਹੁਤ ਕੁਝ ਸਿੱਖ ਸਕਦਾ ਸ਼ਿਲਪਕਾਰੀ ਕਲਾ ਉਹਨਾਂ ਵਿੱਚੋਂ ਇੱਕ ਹੈ ਜਿਸ ਨੂੰ ਆਪਾਂ ਹੈਂਡਕਰਾਫਟ ਆਈਟਮਸ ਕਹਿ ਸਕਦੇ ਹਾਂ ਜਿਵੇਂ ਇਹਦੇ ਵਿੱਚ ਨੇ ਆਪਣੀ ਹੈ ਨਾ ਠੀਕ ਹੈ ਬਹੁਤ ਹਨ ਠੀਕ ਹੈ ਹੋਰ ਵੀ ਕਈ ਚੀਜ਼ਾਂ ਇੰਨਕਲਿਊਡ ਕੀਤੀਆਂ ਜਾ ਸਕਦੀਆਂ ਅਜਿਹੇ ਕਲਾ ਤੋਂ ਸਿੱਖਣ ਨਾਲ ਰੀਵਾਰਡ ਦੀਆਂ ਆਪਣੀਆਂ ਸਕਿੱਲਸ ਡਿਵੈਲਪ ਹੁੰਦੀਆਂ ਠੀਕ ਹੈ ਆਪਾਂ ਕੁਛ ਨਾ ਕੁਛ ਨਵਾਂ ਸਿੱਖਦੇ ਹਾਂ

ਅਤੇ ਉਸ ਕਲਾ ਵਿੱਚ ਤਰ੍ਹਾਂ ਤਰ੍ਹਾਂ ਦੇ ਕੀ ਵਿਚਾਰ ਹੈ ਦੂਜਾ ਆਰਟਿਸਟ ਤੋਂ ਲੈ ਕੇ ਅੱਜ ਕੱਲ੍ਹ ਠੀਕ ਹੈ ਹੈਂਡ ਕਾਫੀ ਚੀਜ਼ਾਂ ਦੇਖਣ ਨਾਲ ਪਾ ਕੇ ਅਤੇ ਅਤੇ ਆਪਾਂ ਵੀ ਕੁਝ ਸਿੱਖੀਏ ਕਰਕੇ ਦੇਖੀਏ ਤਾਂ ਇਸ ਨਾਲ ਕੀ ਬਣਦਾ ਤਾਂ ਜੋ ਆਪਣਾ ਠੀਕ ਹੈ ਆਪਣਾ ਇੱਕ ਬਿਜਨਸ ਜਿਹੜਾ ਚਲਾ ਸਕਦੇ ਹਾਂ ਇਹਨਾਂ ਨਾਲ ਤਾਂ ਇੱਕ ਇਹ ਹੈ ਕਿ ਆਪਣੀ ਮਨਪਸੰਦ ਅਰਨਿੰਗਸ ਸ਼ੁਰੂ ਕੀਤੀ ਜਾ ਸਕਦੀ ਆ ਪ੍ਰੋਜੈਕਟ ਆਪਣਾ ਨਿੱਕਾ ਕੰਮ ਵੀ ਚਲਾ ਸਕਦੇ ਹਾਂ ਮੋਰਓਵਰ ਇਹ ਹੈ ਕਿ ਇਹਦੇ ਨਾਲ ਜਿਹੜੀਆਂ ਸਕਿੱਲਸ ਐਕਟੀਵਿਟੀ ਕਿਸੇ ਚੀਜ਼ ਨੂੰ ਦੇਖਣ ਆਉਣਾ ਚਾਹੀਦੀਆਂ ਬਲਕਿ ਕਿਸ ਤਰ੍ਹਾਂ ਉਸਦੇ ਵਿੱਚ ਆਪਾਂ ਇੱਕ ਨਵੀਂ ਚੀਜ਼ ਭਰ ਸਕਦੇ ਹਾਂ